ਦੇਖੋ ਜੀ ਇਹ ਵਿਕਾਸਸ਼ੀਲ ਸੰਸਾਰ ਅਤੇ ਪੁਰਾਣੇ ਟਾਇਮ 'ਤੇ ਅਸੀਂ ਕੋਈ ਐਨੇ ਸਾਧਨ ਨਹੀਂ ਸੀ ਹੁੰਦੇ ਕਿਧਰੇ ਦੂਰ ਦਰੀਕੇ ਜਾਣ ਵਾਸਤੇ ਫੇਰ ਪੈਦਲ ਚੱਲਦੇ ਹੁੰਦੇ ਸੀ ਪੈਦਲ ਜਾਣਾ ਛੋਟੇ ਬੱਚਿਆਂ ਨੂੰ ਮੋਢਿਆਂ 'ਤੇ ਗੋਦੀਆਂ 'ਚ ਲੈ ਕੇ ਤੁਰ ਤੁਰਨਾ ਕਾਫ਼ੀ ਸਮੇਂ ਪਹਿਲੇ ਐਨੇ ਔਖੇ ਵੇਲੇ ਸੀਗੇ ਹੁਣ ਤਾਂ ਬਹੁਤ ਉਹ ਸਾਇੰਸ ਵੱਧ ਗਈ ਹੈ ਬਹੁਤ ਚੰਗੀਆਂ ਗੱਡੀ ਗੁਡੀਆਂ ਵੀ ਮਿਲ ਲੈ ਲਈਆਂ ਲੋਕਾਂ ਨੇ ਰੋਡ ਵੀ ਬਣ ਗਏ ਉਸ ਵੇਲੇ ਕਦੇ ਰੋਡ ਨਹੀਂ ਸੀ ਹੁੰਦੇ ਪਿੰਡਾਂ ਤੋਂ ਬਹੁਤ ਦਿੱਕਤਾਂ ਆਉਂਦੀਆਂ ਹੁੰਦੀਆਂ ਸੀ ਸਾਨੂੰ ਮੇਰੀ ਵੀ ਉਮਰ ਪੈਂਹਠ ਛਿਆਹਠ ਸਾਲ ਦੀ ਹੋ ਗਈ ਅਸੀਂ ਫੇਰ ਰਾ ਕਿਤੇ ਦੂਰ ਰਿਸ਼ਤੇਦਾਰੀ 'ਚ ਜਾਣਾ ਜਾਂ ਕਿਤੇ ਹੋਰ ਕੰਮ ਲਈ ਜਾਣਾ ਤਾਂ ਫੇਰ ਅਸੀਂ ਸਾਈਕਲ 'ਤੇ ਜਾਣਾ ਕਿਤੇ ਨੇੜੇ ਤੇੜੇ ਪੈਂਚਰ ਹੋ ਜਾਂਦਾ ਸੀ ਕੋਈ ਦੁਕਾਨ ਨਹੀਂ ਸੀ ਹੁੰਦੀ ਫੇਰ ਪੈਦਲ ਹੀ ਤੁਰ ਕੇ ਉੱਥੇ ਦੁਕ ਪੈਂਚਰਾਂ ਵਾਲੀ ਦੁਕਾਨ ਤੱਕ ਜਾਣਾ ਚਿੱਠੀਆਂ ਪੱਤਰ ਵੀ ਕਾਫ਼ੀ ਸਮੇਂ ਬਾਅਦ ਪਾਉਂਦੇ ਹੁੰਦੇ ਸੀਗੇ ਅਤੇ ਫੇਰ ਕਾਫ਼ੀ ਦਿਨਾਂ ਬਾਅਦ ਚਿੱਠੀ ਆਉਂਦੀ ਸੀ ਡਾਕੀਏ ਨੂੰ ਦੇਖੀ ਜਾਂਦੇ ਸੀ ਫ਼ੋਨ ਵਗੈਰਾ ਤਾਂ ਹੁੰਦੇ ਹੈ ਨਹੀਂ ਸੀਗੇ ਹੁਣ ਤਾਂ ਐਨੀਆਂ ਸਹੂਲਤਾਂ ਹੋ ਗਈਆਂ ਜੀ ਹੁਣ ਤਾਂ ਘਰ ਬੈਠੇ ਹੀ ਦੇਸ਼ ਵਿਦੇਸ਼ ਨੂੰ ਫ਼ੋਨ 'ਤੇ ਗੱਲ ਕਰੋ ਅਤੇ ਸਾਰਾ ਕੁਛ ਹੀ ਗੱਡੀ ਮਿਲ ਜਾਂਦੀ ਹੈ ਜੇ ਕਿਸੇ ਕੋਲ ਨਹੀਂ ਤਾਂ ਦੂਸਰੇ ਦੀ ਗੱਡੀ ਦਾ ਵੀ ਫਾਇਦਾ ਲੈ ਲੈਂਦੇ ਹੈ ਰੋਡ ਵਧੀਆ ਬਣ ਗਏ ਨੇ ਕਾਫ਼ੀ ਵਿਕਾਸ ਹੋ ਗਿਆ ਜੀ ਹੁਣ ਅੱਜ ਕੱਲ੍ਹ ਦੇ ਟਾਇਮ 'ਤੇ ਤਾਂ ਬਹੁਤ ਹੀ ਸਹੂਲਤਾਂ ਫੇਰ ਸਕੂਲ ਵੇ ਪਹਿਲਾਂ ਸਕੂਲ ਵੇਲੇ ਜਾਣ ਵੇਲੇ ਕਾਫ਼ੀ ਦਿੱਕਤ ਆਉਂਦੀ ਸੀ ਪਾਣੀ ਨਦੀਆਂ ਨਾਲਿਆਂ ਤੋਂ ਵੀ ਬੈਠੇ ਰਹਿੰਦੇ ਸੀਗੇ ਪਿੱਛੇ ਵੀ ਕਦੋਂ ਪਾਣੀ ਉਤਰੇਗਾ ਤਾਂ ਕਦੋਂ ਜਾਵਾਂਗੇ ਹੁਣ ਤਾਂ ਨਾਲਿਆਂ ਦੀ ਵੀ ਪੁੱਲ ਲੱਗ ਗਏ ਨੇ ਬੜੇ ਆਰਾਮ ਨਾਲ਼ ਗੱਡੀਆਂ 'ਚ ਛੱਡ ਕੇ ਵੀ ਬੱਚਿਆਂ ਨੂੰ ਆ ਜਾਂਦੇ ਨੇ ਵੀ ਐਨੀ ਸਹੂਲਤਾਂ ਹੁਣ ਵਧੀਆ ਜ਼ਮਾਨਾ ਆ ਗਿਆ ਬਹੁਤ ਸਹੂਲਤਾਂ ਦੇ ਫਾਇਦੇ ਲੈ ਰਹੇ ਨੇ ਬੜੀਆਂ ਦਿੱਕਤਾਂ ਪਹਿਲੇ ਟਾਈਮ 'ਤੇ ਅਸੀਂ ਦੂਰ ਤੋਂ ਸਿਰਾਂ ਪਰ ਕੱਖ ਲਿਆਉਣੇ ਹੁਣ ਮਸ਼ੀਨਰੀ ਹੋ ਗਈ ਟਰੈਕਟਰ ਹੋ ਗਏ ਜੀ ਟਰੈਕਟਰ 'ਤੇ ਕੱਖ ਕੰਡਾ ਪਸ਼ੂਆਂ ਨੂੰ ਆਰਾਮ ਨਾਲ਼ ਲੈ ਕੇ ਆਉਂਦੇ ਨੇ ਉਸ ਤਾਂ ਸਮਾਂ ਹੀ ਐਸਾ ਸੀ ਜਦੋਂ ਬਹੁਤ ਬਹੁਤ ਬੁਰੇ ਹਾਲਾਤ ਹੁੰਦੇ ਸੀਗੇ ਕ ਅਤੇ ਹੁਣ ਤਾਂ ਕਾਫ਼ੀ ਸਹੂਲਤਾਂ ਹੋ ਗਈਆਂ ਜੀ ਅੱਜ ਕੱਲ੍ਹ ਤਾਂ ਐਨਾ ਲੋਕਾਂ ਨੂੰ ਆਪਣੇ ਫਾਇਦੇ ਹੋ ਗਏ ਨੇ ਕਿਸੇ ਨੂੰ ਵੀ ਐਡੀ ਦਿੱਕਤ ਨਹੀਂ ਆਉਂਦੀ ਚਿੱਠੀ ਪੱਤਰ ਦੀ ਵੀ ਹੁਣ ਕੋਈ ਲੋੜ ਨਹੀਂ ਹੈ ਫ਼ੋਨ ਸਭ ਸਭ ਕੋਲ ਫ਼ੋਨ ਹੋ ਗਏ ਨੇ ਸਭ ਨੇ ਫ਼ੋਨ ਦੇ ਫਾਇਦੇ ਲਏ ਹੋਏ ਨੇ ਹੁਣ ਜਦੋਂ ਤਾਂ ਡੂਟੀ ਵੀ ਜਾਂਦੇ ਸੀ ਛੁੱਟੀ ਲੈਣੀ ਹੋਵੇ ਕਿਸੇ ਨੇ ਕੋਈ ਜਾਂਦਾ ਹੀ ਸੀ ਦਿਹਾੜੀ ਦੱਪੇ 'ਤੇ ਕੋਈ ਗੱਲ ਨਹੀਂ ਸੀ ਹੁੰਦੀ ਹੁਣ ਅੱਜ ਕੱਲ੍ਹ ਤਾਂ ਮਿੰਟੋ ਮਿੰਟਾਂ 'ਚ ਗੱਲਬਾਤ ਹੋ ਜਾਂਦੀ ਹੈ ਜੀ ਬੜਾ ਅੱਜ ਦਾ ਸਮਾਂ ਬਹੁਤ ਹੀ ਚੰਗਾ ਲੰਘ ਰਿਹਾ ਹੈ